ਮੈਂ ਇੱਕ ਵੂਮੈਨਸ ਡੇ 'ਤੇ ਡਰਾਇੰਗ ਬਣਾਈ ਜਿਸ ਦੇ ਵਿੱਚ ਮੈਨੇ ਔਰਤਾਂ ਦੇ ਸਾਂਝੇ ਦਰਦ ਅਤੇ ਸਾਂਝੇ ਸੁਪਨਿਆਂ ਦੀ ਗੱਲ ਕੀਤੀ ਜਿਸ ਵਿੱਚ ਜਿਸ ਨੂੰ ਜ਼ਿਆਦਾ ਆ ਤੋਂ ਜ਼ਿਆਦਾ ਆਪਣੀ ਜ਼ਿੰਦਗੀ ਅਤੇ ਔਰਤਾਂ ਦੀ ਜ਼ਿੰਦਗੀ ਨਾਲ ਰਿਲੇਟ ਕਰਨ ਦੇ ਲਈ ਮੈਨੇ ਉਹਨਾਂ ਆਪਣੀ ਡਰਾਇੰਗ 'ਤੇ ਬਾਰੇ ਬਾਰੀਕੀ ਦੇ ਵਿੱਚ ਕੰਮ ਕੀਤਾ ਅਤੇ ਜਿਸ ਦੇ ਵਿੱਚ ਮੈਨੇ ਬਹੁਤ ਸਾਰੇ ਅਲੱਗ ਅਲੱਗ ਤਰ੍ਹਾਂ ਦੇ ਕਲਰਸ ਵੀ ਯੂਜ਼ ਕੀਤੇ ਜਿਸ ਨਾਲ ਕੀ ਮੇਰੀ ਜਿਹੜੀ ਡਰਾਇੰਗ ਆ ਹੋਰ ਵੀ ਜ਼ਿਆਦਾ ਵਧੀਆ ਬਿਹਤਰ ਅਤੇ ਸਭ ਨੂੰ ਅਟਰੈਕਟ ਕਰਨ ਵਾਲੀ ਬਣੀ ਅਤੇ ਇਸ ਡਰਾਇੰਗ ਕੋਪੀਟੀਸ਼ਨ ਦੇ ਵਿੱਚ ਮੈਨੂੰ ਸੈਕਿੰਡ ਪਜ਼ੀਸ਼ਨ ਵੀ ਮਿਲੀ ਅਤੇ ਇਹ ਡਰਾਇੰਗ ਮੇਰੀ ਮੇ ਮੇਰੇ ਕੋਲਜ ਦੇ ਗੇ ਮੇਰੇ ਕੋਲਜ ਦੇ ਵਿੱਚ ਲਗਾਈ ਗਈ ਅਤੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਇਸ ਚੀਜ਼ ਦੀ ਜਦੋਂ ਮੇਰੀ ਡਰਾਇੰਗ ਇੰਨੀ ਜ਼ਿਆਦਾ ਇਹਨਾਂ ਲੋਕਾਂ ਨੇ ਪਸੰਦ ਕੀਤੀ ਅਤੇ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਡਰਾਇੰਗ ਕਰਨਾ ਅਤੇ ਮੈਂ ਹਰ ਛੋਟੀ ਮੋਟੀ ਫੰਕਸ਼ਨਸ 'ਤੇ ਡਰਾਇੰਗ ਕਰਨਾ ਪਸੰਦ ਕਰਦੀ ਹਾਂ ਅਤੇ ਇਹ ਕੋਈ ਪਹਿਲੀ ਵਾਰ ਨਹੀਂ ਸੀ ਮੈਨੇ ਕਈ ਵਾਰ ਆਪਣੇ ਸਕੂਲ ਕੋਲਜ ਦੇ ਵਿੱਚ ਡਰਾਇੰਗਸ ਕੀਤੀਆਂ ਹਨ ਜੋ ਕਿ ਮੈਨੂੰ ਕਰਨਾ ਬਹੁਤ ਹੀ ਪਸੰਦ ਹੈ ਅਤੇ ਮੈਂ ਜ਼ਿਆਦਾਤਰ ਕੁਦਰਤੀ ਡਰਾਇੰਗਸ ਕਰਨਾ ਪਸੰਦ ਕਰਦੀ ਹਾਂ ਪਰ ਕਈ ਵਾਰ ਕੋਈ ਫੰਕਸ਼ਨਸ ਜਾਂ ਕੋਈ ਤਿਉਹਾਰ ਜਾਂ ਵੂਮੈਨਸ ਡੇ ਵਗੈਰਾ ਚਿਲਡਰਨ ਡੇਜ਼ ਵਗੈਰਾ 'ਤੇ ਵੀ ਇਹਨਾਂ ਚੀਜ਼ਾਂ ਤੇ ਬਣ ਡਰਾਇੰਗ ਕਰਨਾ ਪਸੰਦ ਕਰਦੀ ਹਾਂ